ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਵਿੱਚ ਸਾਡੇ ਪੰਜਾਬ ਵਿੱਚ ਪੰਜਾਬੀ ਸਾਡੀ ਮੇਨ ਪਹਿਚਾਣ ਹੈ ਪੰਜਾਬੀ ਸਾਡੀ ਮਾਂ ਬੋਲੀ ਸਮਾਨ ਹੈ ਅੱਜ ਕੱਲ੍ਹ ਤਾਂ ਸਾਰੇ ਕਿਤੇ ਪੰਜਾਬ ਵਿਚ ਪੰਜਾਬੀ ਹੀ ਬੋਲੀ ਜਾਂਦੀ ਹੈ ਅਗਰ ਪਹਿਲੇ ਮੰਨਿਆ ਜਾਵੇ ਪਹਿਲੇ ਪੰਜਾਬੀ ਨੂੰ ਇੰਨਾਂ ਮੁਹਤਾਜ ਨਹੀਂ ਦਿੱਤਾ ਗਿਆ ਪਰ ਹੁਣ ਤਾਂ ਜੋ ਸਮੇਂ ਵਿੱਚ ਪੰਜਾਬੀ ਸਾਡੇ ਲਈ ਬਹੁਤ ਕੰਪਲਸਰੀ ਹੋਈ ਜਾ ਰਹੀ ਹੈ ਅਗਰ ਕਿਸੇ ਨੇ ਜੋਬ ਵਗੈਰਾ ਅਪਲਾਈ ਕਰਨੀ ਹੋਵੇ ਪੰਜਾਬ ਵਿੱਚ ਉਸ ਨੂੰ ਵੀ ਪਹਿਲਾਂ ਪੰਜਾਬੀ ਸਿੱਖਣੀ ਪਵੇਗੀ ਪੰਜਾਬੀ ਸਾਡੇ ਪੰਜਾਬ ਲਈ ਬਹੁਤ ਕੰਪਲਸਰੀ ਮੰਨੀ ਜਾਂਦੀ ਹੈ ਅਗਰ ਕੋਈ ਵੀ ਸਟੂਡੈਂਟ ਪੜ੍ਹਦਾ ਹੋਵੇ ਬਾਹਰ ਭਾਵੇਂ ਤੁਸੀਂ ਇੰਗਲਿਸ਼ ਵੀ ਮੀਡੀਅਮ ਹੋਵੇ ਉਸ ਨੂੰ ਵੀ ਪੰਜਾਬੀ ਬਹੁਤ ਜ਼ਰੂਰੀ ਹੋਵੇਗੀ ਪੰਜਾਬੀ ਸਾਡੇ ਪੰਜਾਬ ਦੀ ਮਾਤਰ ਭਾਸ਼ਾ ਹੈ ਪੰਜਾਬ ਵਿੱਚ ਰਹਿਣ ਲਈ ਪੰਜਾਬੀ ਸਿੱਖਣਾ ਬਹੁਤ ਕੰਪਲਸਰੀ ਮੰਨਿਆ ਜਾਂਦਾ ਹੈ ਪੰਜਾਬੀ ਪ ਪੰਜਾਬੀ ਭਾਸ਼ਾ ਪੰਜਾਬ ਦੀ ਆਨ ਅਤੇ ਸ਼ਾਨ ਹੈ ਅਤੇ ਪੰਜਾਬ ਵਿੱਚ ਰਹਿਣ ਵਾਲੇ ਹਰ ਇੱਕ ਨੌਜਵਾਨ ਨੂੰ ਪੰਜਾਬੀ ਆਉਣਾ ਲਾਜ਼ਮੀ ਹੋ ਗਿਆ ਹੈ ਪੰਜਾਬ ਵਿੱਚ ਜਿਹੜਾ ਬਾਹਰਲਾ ਕੋਈ ਬੰਦਾ ਆਉਂਦਾ ਹੈ ਅਤੇ ਉਸਨੂੰ ਪਹਿਲਾਂ ਪੰਜਾਬੀ ਬਾਰੇ ਪੁੱਛਿਆ ਜਾਂਦਾ ਉਸ ਨੂੰ ਉਸ ਨੂੰ ਪੰਜਾਬੀ ਬਾਰੇ ਦੱਸਿਆ ਜਾਂਦਾ ਹੈ ਪੰਜਾਬ ਵਿੱਚ ਪੰਜਾਬ ਵਿੱਚ ਕੁਛ ਵੀ ਕੰਮ ਕਰਨਾ ਹੈ ਤਾਂ ਪੰਜਾਬੀ ਪਹਿਲੇ ਨੰਬਰ 'ਤੇ ਆਉਂਦੀ ਹੈ ਪੰਜਾਬੀ ਪੰਜਾਬ ਦੀ ਮਾਤਰ ਭਾਸ਼ਾ ਹੈ ਪੰਜਾਬੀ ਨ ਪੰਜਾਬ ਵਿੱਚ ਹੀ ਰਹਿਣਾ ਪੰਜਾਬੀ ਲਾਜ਼ਮੀ ਹੋ ਗਿਆ ਹੈ ਆਦਿ